ਮੈਂ ਫਲਿੱਪਕਾਰਟ ਤੋਂ ਔਨਲਾਈਨ ਨੋਵਲ ਮੰਗਵਾਇਆ ਸੀ ਪਿਛਲੇ ਦਿਨਾਂ ਦੇ ਵਿੱਚ ਮੈਂ ਔਨਲਾਈਨ ਜਦੋਂ ਬੁਕਿੰਗ ਕੀਤੀ ਸੀਗੀ ਨੋਵਲ ਦੀ ਤਾਂ ਉਹਨਾਂ ਨੇ ਇੱਕ ਹਫ਼ਤੇ ਦੇ ਵਿੱਚ ਵਿੱਚ ਡਿਲੀਵਰੀ ਦਾ ਕਿਹਾ ਸੀਗਾ ਵੀ ਇੱਕ ਹਫ਼ਤੇ ਦੇ ਵਿੱਚ ਜਿਹੜੀ ਡਿਲੀਵਰੀ ਹੋ ਜੇਗੀ ਪਰ ਉਸ ਤੋਂ ਪਹਿਲਾਂ ਹੀ ਉਹਨਾਂ ਨੇ ਜਿਹੜੀ ਮੇਰੀ ਮੇਰਾ ਨੋਵਲ ਹੈ ਮੇਰੇ ਕੋਲ ਪਹੁੰਚਾ ਤਾ ਅਤੇ ਉਹਨਾਂ ਦੇ ਜਿਹੜਾ ਡਿਲੀਵਰੀ ਨ ਦੇ ਸਮੇਂ ਜਿਹੜੀ ਉਹਨਾਂ ਨੇ ਨੋਵਲ ਦਿੱਤਾ ਗਾ ਉਹਦੀ ਪੈਕਿੰਗ ਬਹੁਤ ਚੰਗੀ ਸੀਗੀ ਕਿਤੋਂ ਵੀ ਕੋਈ ਜਿਹੜੀ ਕਿਤਾਬ ਸੀ ਉਹ ਕਟੀ ਫਟੀ ਨਹੀਂ ਹੋਈ ਸੀਗੀ ਨਾ ਹੀ ਉਹਦਾ ਕੋਈ ਪੇਜ਼ ਉੱਖੜਿਆ ਹੋਇਆ ਸੀਗਾ ਉਹਨਾਂ ਦੀ ਜਿਹੜੀ ਵਾਇਡਿੰਗ ਸੀ ਬੁੱਕ ਦੀ ਉਹ ਬਹੁਤ ਚੰਗੀ ਸੀਗੀ ਅਤੇ ਜਿਹੜਾ ਨੋਵਲ ਦਾ ਚੰਗਾ ਉਹਨਾਂ ਨੇ ਜਿਹੜਾ ਨੋਵਲ ਆ ਸਾਨੂੰ ਪ੍ਰੋਵਾਈਡ ਕੀਤਾ ਅਤੇ ਉਹਦੇ ਲਈ ਉਹਨਾਂ ਦਾ ਧੰਨਵਾਦ